ਪੰਜਾਬ ਦੀ ਸਿੱਖਿਆ ਪ੍ਰਣਾਲੀ ਬਹੁਤ ਹੀ ਵਧੀਆ ਹੋ ਗਈ ਹੈ ਜਿਵੇਂ ਕਿ ਅੱਜ ਕੱਲ੍ਹ ਦੇ ਮਤਲਬ ਬਹੁਤ ਸਾਰੇ ਸਰਕਾਰੀ ਸਕੂਲ ਥਾਂ ਥਾਂ 'ਤੇ ਮਤਲਬ ਹਰ ਕਿਸੇ ਸਕੂਲ ਹਰ ਕਿਸੇ ਸ਼ਹਿਰ ਵਿੱਚ ਹਰ ਕਿਸੇ ਪਿੰਡਾਂ ਵਿੱਚ ਓਪਨ ਕੀਤਾ ਜਾਣ ਡੇ ਕਿਉਂਕਿ ਜਿਹੜਾ ਭਗਵੰਤ ਮਾਨ ਹੈ ਉਹਨੇ ਮਤਲਬ ਕਿ ਹੁਣ ਆਪਣੀ ਜਿਹੜੀ ਸਿੱਖਿਆ ਹੈ ਉਹ ਬਹੁਤ ਜ਼ਿਆਦਾ ਸਟਰੋਂਗ ਕਰਤੀ ਹੋਈ ਆ ਪਹਿਲੇ ਜਮਾਨੇ ਵਿੱਚ ਹੁੰਦਾ ਸੀ ਕਿ ਸਰਕਾਰੀ ਸਕੂਲਾਂ ਵਿੱਚ ਮਤਲਬ ਬੱਚਿਆਂ ਵੱਲ ਇੰਨਾ ਧਿਆਨ ਨਹੀਂ ਦਿੱਤਾ ਜਾਂਦਾ ਹੁੰਦਾ ਸੀ ਕਿ ਉਹਨਾਂ ਦੀ ਜਿਹੜੀ ਸਿੱਖਿਆ ਹੈ ਉਹਦੇ ਵੱਲ ਇੰਨਾ ਜ਼ਿਆਦਾ ਫੋਕਸ ਨਹੀਂ ਕੀਤਾ ਜਾਂਦਾ ਸੀ ਕਿ ਉਹਨਾਂ ਨੂੰ ਮਤਲਬ ਕਿ ਬੇਸਿਕ ਹੀ ਉਹਨਾਂ ਦੇ ਮਤਲਬ ਕਲੀਅਰ ਨਹੀਂ ਕੀਤੇ ਜਾਂਦੇ ਸੀ ਪਰ ਹੁਣ ਜਿਹੜੇ ਸਕੂਲਜ਼ ਆ ਉਹ ਬਹੁਤ ਹੀ ਜ਼ਿਆਦਾ ਵਧੀਆ ਤਰ੍ਹਾਂ ਬਣ ਗਏ ਹੋਏ ਆ ਕੰਸਟਰਕਸ਼ਨ ਮਤਲਬ ਅਲੱਗ ਅਲੱਗ ਬਿਲਡਿੰਗਸ ਬਣਾਈਆਂ ਗਈਆਂ ਇਹ ਸਕੂਲਾਂ ਵਿੱਚ ਹੀ ਮਤਲਬ ਕਿ ਬੱਚਿਆਂ ਨੂੰ ਬਹੁਤ ਜ਼ਿਆਦਾ ਸਹੂਲਤਾਂ ਦਿੱਤੀਆਂ ਗਈਆਂ ਉਹਨਾਂ ਨੂੰ ਐਕਟੀਵਿਟੀਜ਼ ਕਰਨੀਆਂ ਕ ਕਰਵਾਈਆਂ ਜਾਂਦੀਆਂ ਜਿਵੇਂ ਕਿ ਪੇਂਟਿੰਗ ਕਰਵਾਈ ਜਾਂਦੀ ਹੈ ਉਹਨਾਂ ਨੂੰ ਐਕਸਰਸਾਈਜ਼ ਕਰਵਾਈ ਜਾਂਦੀ ਆ ਯੋਗਾ ਕਰਾਇਆ ਜਾਂਦਾ ਹੈ ਪੀ ਟੀ ਕਲਾਸ ਲਗਾਈ ਜਾਂਦੀ ਹੈ ਜਿਹਦੇ ਨਾਲ ਬੱਚੇ ਵੀ ਮਤਲਬ ਕਿ ਬੜੇ ਜ਼ਿਆਦਾ ਮਤਲਬ ਪ੍ਰਭਾਵਿਤ ਹੁੰਦੇ ਆ ਸਕੂਲ ਜਾਂਦੇ ਆ ਕੋਲਜ ਜਾਂਦੇ ਆ ਕਲਾਸਾਂ ਅਟੈਂਡ ਕਰਦੇ ਆ ਕਿ ਜਿੱਦਾਂ ਕਿ ਆਪਾਂ ਨੂੰ ਮਤਲਬ ਕਿ ਆਪਣੇ ਨੋਲੇਜ ਹੈ ਮਤਲਬ ਅਲੱਗ ਅਲੱਗ ਗੇਮ ਕਰਨੀ ਚਾਹੀਦੀ ਹੈ ਹੁਣ ਜਿਹੜੇ ਆ ਟੀਚਰਸ ਬੜੇ ਜ਼ਿਆਦਾ ਸਕੂਲਾਂ ਵਿੱਚ ਟੀਚਰ ਰੱਖੇ ਗਏ ਆ ਬੱਚਿਆਂ ਦਾ ਉੱਥੇ ਹੀ ਖਾਣਾ ਦਿੱਤਾ ਜਾਂਦਾ ਉਹਨਾਂ ਨੂੰ ਮਤਲਬ ਵਧੀਆ ਤਰ੍ਹਾਂ ਮਤਲਬ ਪਿੱਛੇ ਜੇ ਮਤਲਬ ਗੱਲ ਵੀ ਚਲੀ ਸੀ ਕਿ ਬੱਚਿਆਂ ਨੂੰ ਮਤਲਬ ਕਿ ਸਰਕਾਰੀ ਸਕੂਲਾਂ ਵਿੱਚ ਮੈਡਮ ਨਾਲ ਮੈਡਮਾਂ ਮਿਸਬਿਹੇਵ ਕਰਦੀਆਂ ਬੱਚਿਆਂ ਨਾਲ ਬਟ ਹੁਣ ਮਤਲਬ ਕਿ ਦਿਨੋਂ ਦਿਨ ਕਰਕੇ ਆਪਣਾ ਜਿਹੜਾ ਮਤਲਬ ਕਿ ਇਰਾ ਹੈ ਆਪਣੀ ਜਿਹੜੀ ਨੌਲੇਜ ਹੈ ਉਹ ਇਨਕਰੀਜ ਹੁੰਦੀ ਹੈ ਆਪਣੀ ਜਿਹੜੀ ਐਜੂਕੇਸ਼ਨ ਲੈਵਲ ਹੈ ਉਹ ਇਨਕਰੀਜ ਹੋਣ ਡਿਆ ਹੈ ਕਿ ਅਲੱਗ ਸਕੈਡਰੀ ਸਕੂਲਜ਼ ਓਪਨ ਕੀਤੇ ਗਏ ਆ ਪ੍ਰਾਈਮਰੀ ਸਕੂਲਜ਼ ਓਪਨ ਕੀਤੇ ਗਏ ਆ ਬੱਚਿਆਂ ਨੂੰ ਅਲੱਗ ਅਲੱਗ ਐਕਟੀਵਿਟੀਜ਼ ਆਪਣੇ ਇਤਿਹਾਸ ਆਪਣੇ ਵੈਸਟਰਨ ਟ੍ਰੀਡੀਸ਼ਨਲ ਡਿਵੈਲਪਮੈਂਟ ਇਹਨਾਂ ਚੀਜ਼ਾਂ ਬਾਰੇ ਮਤਲਬ ਬੱਚਿਆਂ ਨੂੰ ਮਤਲਬ ਸਿਖਾਇਆ ਜਾ ਰਿਹਾ ਉਹਨਾਂ ਨੂੰ ਅੱਗੇ ਵਧਾਇਆ ਜਾਣਦਿਆ ਕਿ ਉਹ ਅਲੱਗ ਅਲੱਗ ਅ ਸਪੋਰਟਸ ਦੇ ਵਿੱਚ ਭਾਗ ਲੈਣ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਕਿ ਮਤਲਬ ਕਿ ਆਪਾਂ ਕਹਿ ਦਿੰਦੇ ਹਾਂ ਸਰਕਾਰੀ ਸਕੂਲ ਅਤੇ ਸੀ ਬੀ ਐੱਸ ਈ ਸਕੂਲ ਪ੍ਰਾਈਵੇਟ ਔਰ ਸਰਕਾਰੀ ਸਕੂਲ ਵਿੱਚ ਇੰਨਾ ਜ਼ਿਆਦਾ ਡਿਫਰੈਂਸ ਨਹੀਂ ਹੈਗਾ ਦੋਵੇਂ ਹੀ ਮਤਲਬ ਕਿ ਇੱਕੋ ਜਿਹੇ ਹੈਗੇ ਆ ਦੋਵਾਂ ਵਿੱਚ ਇੱਕੋ ਹੀ ਪੜ੍ਹਾਈ ਪੜ੍ਹੀ ਜਾਂਦੀ ਆ ਬਸ ਇਹ ਆ ਕਿ ਉੱਥੇ ਫੀਸਾਂ ਲਈਆਂ ਜਾਂਦੀਆਂ ਉੱਥੇ ਫੀਸਾਂ ਨਹੀਂ ਲਈਆਂ ਜਾਂਦੀਆਂ ਹਾਂ ਮਤਲਬ ਕਿ ਥੋੜ੍ਹੀ ਬਹੁਤ ਰਹਿ ਜਾਂਦੀ ਆ ਪਰ ਪ੍ਰੈਫਰ ਪ੍ਰਾਈਮਰੀ ਸਕੂਲਜ਼ ਅਤੇ ਸਕੈਂਡਰੀ ਸਕੂਲਜ਼ ਵੀ ਬਹੁਤ ਜ਼ਿਆਦਾ ਵਧੀਆ ਹੈਗੇ